ਹਾਂਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਪਰਿਵਾਰਕ ਪਕਵਾਨ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਮਸ਼ਹੂਰ ਸਰ੍ਹੋਂ ਦਾ ਸਾਗ ਮੱਕੀ ਦੀ ਰੋਟੀ ਮੱਖਣ ਦਹੀ ਲੱਸੀ ਜਿਵੇਂ ਸਾਗ ਜੋ ਹੈ ਬਿਨਾ ਦਹੀਂ ਮੱਕੀ ਦੀ ਰੋਟੀ ਤੋਂ ਪੂਰਾ ਨਹੀਂ ਮੰਨਿਆ ਜਾਂਦਾ ਸਾਗ ਬਣਾਉਣ ਦੀ ਪ੍ਰਕਿਰਿਆ ਕੁਛ ਇਸ ਤਰ੍ਹਾਂ ਪਹਿਲਾਂ ਆਪਾਂ ਖੇਤਾਂ ਤੋਂ ਤੋੜ ਕੇ ਲਿਆਉਂਦੇ ਹਾਂ ਧੋਂਦੇ ਹਾਂ ਫਿਰ ਕੱਟਣਾ ਪੈਂਦਾ ਅਤੇ ਅਖੀਰ ਵਿੱਚ ਉਹਨੂੰ ਪਕਾਇਆ ਜਾਂਦਾ ਗੈਸ ਜਾਂ ਚੁੱਲ੍ਹੇ 'ਤੇ ਚੁੱਲ੍ਹੇ ਦਾ ਜੋ ਹੈ ਸਵਾਦ ਜ਼ਿਆਦਾ ਵਧੀਆ ਲੱਗਦਾ ਪਿੰਡਾਂ ਵਿੱਚ ਅੱਜ ਵੀ ਚੁੱਲ੍ਹਿਆਂ 'ਤੇ ਬਣਾਇਆ ਜਾਂਦਾ ਅਤੇ ਅਖੀਰ ਵਿੱਚ ਆਪਾਂ ਅੱਲਣ ਵੀ ਐਡ ਕਰਦੇ ਹਾਂ ਅਤੇ ਫਿਰ ਆਪਾਂ ਤੜਕਾ ਲਗਾ ਕੇ ਉਹਨੂੰ ਫਾਈਨਲ ਟੱਚ ਦਿੰਦੇ ਹਾਂ ਸਾਗ ਜੋ ਆ ਪੀੜੀਆਂ ਤੋਂ ਚੱਲਿਆ ਆ ਰਿਹਾ ਅਤੇ ਇਹ ਖਾਣ ਵਿੱਚ ਵੀ ਬਹੁਤ ਸਵਾਦ ਅਤੇ ਸਾਨੂੰ ਯਕੀਨ ਹੈ ਕਿ ਅਗਾਂਹ ਸਾਡੀ ਪੀੜੀਆਂ ਵੀ ਸਾਡੇ ਬੱਚੇ ਵੀ ਇਹਨੂੰ ਬਹੁਤ ਪਸੰਦ ਕਰਨਗੇ ਅਤੇ ਕਰਦੇ ਹਨ ਥੈਂਕ ਯੂ